ਚਿਤਰਕਾਰੀ ਇਕ ਬਹੁਤ ਹੀ ਵਧੀਆ ਪੈਂਟਿੰਗ ਹੈ ਮੈਨੂੰ ਡਰਾਇੰਗ ਹੀ ਬਹੁਤ ਹੀ ਪਸੰਦ ਹੈ ਡਰਾਇੰਗ ਵਿੱਚ ਮੈਂ ਹਿੱਸਾ ਲਿਆ ਸੀ ਮੇਰੇ ਵੱਧ ਸਭ ਤੋਂ ਵੱਧ ਨੰਬਰ ਆਏ ਸਨ ਪੈਂਟਿੰਗ ਵਿੱਚ ਮੈਨੂੰ ਕਿਤਾਬ ਬਣਾਉਣੀ ਵਧੀਆ ਲੱਗਦੀ ਹੈ ਅਤੇ ਇਹ ਪੈਂਟਿੰਗ ਕਲਰਾਂ ਪੈਨਸਲਾਂ ਨਾਲ ਵੀ ਬਣਾਈ ਸਕਦੀ ਹੈ ਇਸ ਦੇ ਨਾਲ ਪੈਂਟਿੰਗ ਦੀ ਮਦਦ ਨਾਲ ਬਹੁਤ ਹੀ ਵਧੀਆ ਇਨਾਮ ਮਿਲਦੇ ਹਨ ਅਤੇ ਮੇਰੀ ਸਹੇਲੀਆਂ ਨੂੰ ਪੈਂਟਿੰਗ ਕਰਨੀ ਮੈਂ ਸਿਖਾ ਦਿਤੀ ਪੈਂਟਿੰਗ ਬਹੁਤ ਹੀ ਵਧੀਆ ਮੇਰੇ ਪੈਂਟਿੰਗ ਬਹੁਤ ਵਧੀ ਫੁੱਲ ਬਣਾਇਆ ਮੈਂ ਅਤੇ ਮੈਂ ਆਪਣੀ ਸਹੇਲੀਆਂ ਨੂੰ ਵੀ ਪੈਂਟਿੰਗ ਕਰਨੀ ਸਿਖਾਈ ਇਹ ਪੈਂਟਿੰਗ ਬਹੁਤ ਹੀ ਕਲਰ ਵਧੀਆ ਕਲਰਾਂ ਨਾਲ ਬਣਾਈ ਜਾ ਸਕਦੀ ਹੈ ਅਤੇ ਫੇਵਰਟ ਸਨ ਮੇਰੀ ਇਹ ਕਲਰ ਫੇਵਰਟ